ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਿਥੀ ਸਥਿਤੀ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਔਰਤਾਂ ਦੇ ਸਾਹਮਣੇ ਲਿੰਗ ਸਮਾਨਤਾ ਵਿਤਕਰਾ ਦਾ ਮੁੱਖ ਚੁਣੌਤੀਆਂ ਦੇ ਮੌਕੇ ਹਨ ਜੋ ਬਹੁਤ ਜਿਆਦਾ ਵਿਤਕਰਾ ਹੁੰਦੇ